ਇਹ ਪੰਜਾਬੀ ਬੋਲੀ ਸਾਡੀ ਮਾਤ ਭਾਸ਼ਾ ਹੈ ਅਤੇ ਅਸ ਅਤੇ ਅਸੀਂ ਇਹਨੂੰ ਆਪਣਾ ਬੱਚੇ ਵੀ ਸਾਡੇ ਵਧੀਆ ਤਰੀਕੇ ਨਾਲ ਬੋਲਦੇ ਆ ਪਰ ਅੱਜ ਕੱਲ ਸਕੂਲਾਂ ਕੋਲਜਾਂ ਵਿੱਚ ਬੱਚਿਆਂ ਨੂੰ ਪੰਜਾਬੀ ਬਾਰੇ ਬਹੁਤ ਘੱਟ ਦੱਸਿਆ ਜਾਂਦਾ ਅਤੇ ਬਹੁਤ ਘੱਟ ਹੀ ਪੜ੍ਹਾਇਆ ਜਾਂਦਾ ਹੈ ਕਿ ਪੰਜਾਬੀ ਦੀ ਸਾਡੇ ਲਈ ਕੀ ਮਹੱਤਤਾ ਤਾਂ ਜੋ ਸਾਡੇ ਬੱਚੇ ਇਹ ਆਪਣਾ ਪੰਜਾਬੀ ਨਾਲੋਂ ਅਲੱਗ ਟੁੱਟ ਰਹੇ ਆ ਮੈਂ ਚਾਹੁੰਦਾ ਹਾਂ ਕਿ ਬੱਚਿਆਂ ਨੂੰ ਸਕੂਲਾਂ ਕਾਲਜਾਂ ਵਿੱਚ ਕੰਪਲਸਰੀ ਪੰਜਾਬੀ ਕਰੀ ਜਾਵੇ ਤਾਂ ਜੋ ਹਰ ਇੱਕ ਬੱਚੇ ਨੂੰ ਡੀਪਲੀ ਸਮਝਾਇਆ ਜਾਵੇ ਕਿ ਪੰਜਾਬੀ ਸਾਡੇ ਲਈ ਕੀ ਮਹੱਤਤਾ ਰੱਖਦੀ ਹੈ ਅਤੇ ਬੈਂਕਾਂ ਵਿੱਚ ਵੀ ਪੰਜਾਬੀ ਬਹੁਤ ਘੱਟ ਬੋਲੀ ਜਾਂਦੀ ਹੈ ਉਹ ਵੀ ਅੰਗਰੇਜ਼ੀ ਵਿੱਚ ਗੱਲ ਕਰਦੇ ਹਨ ਤਾਂ ਜੋ ਸਾਨੂੰ ਉਹਨਾਂ ਦੀਆਂ ਕਈ ਗੱਲਾਂ ਸਮਝ ਵੀ ਨਹੀਂ ਔ ਆਉਂਦੀਆਂ ਹੈਗੀਆਂ ਅਤੇ ਹੋਰ ਕਈ ਆਪਣਾ ਅਦਾਲਤਾਂ ਹੋ ਗਈਆਂ ਅਦਾਲਤਾਂ ਵਿੱਚ ਵੀ ਹ ਜੋ ਵੀ ਕੰਮ ਕੀਤਾ ਜਾਂਦਾ ਉਹ ਵੀ ਅੰਗਰੇਜ਼ੀ ਵਿੱਚ ਕੀਤਾ ਜਾਂਦਾ ਜਿਹੜਾ ਆਮ ਲੋਕਾਂ ਦੀ ਸਮਝ ਤੋਂ ਬਾਹਰ ਰਹਿੰਦਾ ਹੈ ਮੈਂ ਚਾਹੁੰਦਾ ਹਾਂ ਹਰ ਇੱਕ ਅਦਾਰੇ 'ਚ ਪੰਜਾਬੀ ਵੱਧ ਤੋਂ ਵੱਧ ਇਹਨਾਂ ਨੂੰ ਪ੍ਰਫੁੱਲਿਤ ਕੀਤਾ ਜਾਵੇ ਅਤੇ ਇਹਨਾਂ ਬਾਰੇ ਵੱਧ ਤੋਂ ਵੱਧ ਸੋਚਿਆ ਜਾਵੇ ਤਾਂ ਜੋ ਸਾਨੂੰ ਇਸ ਬਾਰੇ ਗਿਆਨ ਪ੍ਰਾਪਤ ਹੋਵੇ ਅਤੇ ਪੰਜਾਬੀ ਸਾਡੇ ਲਈ ਕੀ ਮਹੱਤਤਾ ਰੱਖਦੀ ਹੈ